ਅਸੀਂ ਆਪਣੇ ਨੇੜਲੇ ਕਸਬੇ ਜਾਂ ਪਿੰਡਾਂ ਦੀ ਗੱਲ ਕਰੀਏ ਤਾਂ ਮੈਂ ਜਿੱਦਾਂ ਇਹ ਜਿਹੜਾ ਅਧਿਆਪਕ ਕਿੱਤੇ ਨਾਲ ਜੁੜੀ ਹੋਈ ਹਾਂ ਪ੍ਰੋਫੈਸਰ ਹਾਂ ਇਸ ਕਰਕੇ ਸਾਨੂੰ ਜਿਹੜਾ ਹੈਗਾ ਸਮੇਂ ਸਮੇਂ 'ਤੇ ਜਿਹੜਾ ਹੈਗਾ ਸਾਨੂੰ ਕੋਲਜ ਵਲੋਂ ਕੰਮ ਦਿੱਤਾ ਜਾਂਦਾ ਵੀ ਤੁਸੀਂ ਐਡਮਿਸ਼ਨਾ ਕਰਵਾਉਣੀਆਂ ਨੇ ਅਤੇ ਬੱਚਿਆਂ ਦਾ ਵੇਰਵਾ ਲੈ ਕੇ ਆਉਣਾ ਅਤੇ ਉਹਨਾਂ ਨੂੰ ਜਾ ਕੇ ਆਪਣੇ ਜਿਹੜਾ ਹੈਗਾ ਪ੍ਰੋਫੈਸ਼ਨ ਬਾਰੇ ਜਾਣਕਾਰੀ ਦੇਣੀ ਹੈ ਇਸ ਕਰਕੇ ਬਹੁਤ ਵਾਰ ਮੌਕਾ ਮਿਲਿਆ ਅੱਡ ਅੱਡ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਸਕੂਲਾਂ ਨੂੰ ਵਿਜ਼ਿਟ ਕਰਦੇ ਹਾਂ ਜਾਂ ਅਸੀਂ ਪਿੰਡਾਂ ਕਸਬਿਆਂ ਦੀਆਂ ਪੰਚਾਇਤਾਂ ਜਾਂ ਜਿਹੜਾ ਵੀ ਉੱਥੇ ਕੋਈ ਇੱਦਾਂ ਦੀ ਸੰਸਥਾ ਜਿੱਥੇ ਸਾਨੂੰ ਬੱਚਿਆਂ ਦਾ ਵੇਰਵਾ ਮਿਲ ਸਕਦਾ ਅਸੀਂ ਉੱਥੇ ਜਾ ਕੇ ਉਹਨਾਂ ਨੂੰ ਬਲਾਉਂਦੇ ਵੀ ਹਾਂ ਅਤੇ ਇਕੱਠ ਕਰਕੇ ਉਹਨਾਂ ਨੂੰ ਆਪਣੇ ਜਿਹੜੇ ਇੰਜੀਨੀਅਰਿੰਗ ਦੇ ਕਿੱਤੇ ਬਾਰੇ ਦੱਸਦੇ ਹਾਂ ਵੀ ਕਿੱਦਾਂ ਇਹਦਾ ਫਾਇਦਾ ਕੀ ਨੌਕਰੀਆਂ ਨੇ ਅਤੇ ਬਹੁਤ ਵਾਰੀ ਮੌਕਾ ਮਿਲਿਆ ਮੈਂ ਪੰਦਰਾਂ ਸਾਲ ਹੋ ਗਏ ਇਸ ਪ੍ਰੋਫੈਸ਼ਨ ਦੇ ਵਿੱਚ ਅਤੇ ਉਦੋਂ ਤੋਂ ਲੈ ਕੇ ਅਲੱਗ ਅਲੱਗ ਕੋਲਜਾਂ ਦੇ ਵਿੱਚ ਮੈਂ ਨੌਕਰੀ ਕੀਤੀ ਹੈ ਅਤੇ ਹਰੇਕ ਕਾਲਜ ਦਾ ਆਪਣਾ ਅਲੱਗ ਮੰਤਵ ਹੁੰਦਾ ਸੀਗਾ ਭੇਜਣ ਦਾ ਅਤੇ ਉਸ ਟਾਈਮ ਦੇ ਵਿੱਚ ਕਦੇ ਅਸੀਂ ਪ੍ਰਿੰਸਪਲ ਸਾਹਿਬਾਂ ਨੂੰ ਮਿਲ ਰਹੇ ਹਾਂ ਜਿਹੜੇ ਸਾਨੂੰ ਬੱਚਿਆਂ ਨਾਲ ਅੱਗੇ ਮੁਖਾਤਿਵ ਕਰਾਉਂਦੇ ਸੀਗੇ ਅਤੇ ਕਦੇ ਅਸੀਂ ਜਿਹੜਾ ਹੈਗਾ ਪੰਚਾਇਤਾਂ ਨੂੰ ਮਿਲ ਰਹੇ ਹਾਂ ਉਹਨਾਂ ਨੂੰ ਜਾ ਕੇ ਅਸੀਂ ਆਪਣੀਆਂ ਜਿਹੜੀਆਂ ਸਕੋਲਰਸ਼ਿਪ ਸਕੀਮਾਂ ਨੇ ਬੱਚਿਆਂ ਨੂੰ ਵਜ਼ੀਫੇ ਦਿੱਤੇ ਜਾਂਦੇ ਨੇ ਜਾਂ ਹੋਰ ਪੜ੍ਹਾਈ ਦੇ ਦੌਰਾਨ ਜਿਹੜੇ ਉਹਨਾਂ ਨੂੰ ਫਾਇਦੇ ਨੇ

ਪੋਸਟ ਮੈਟ੍ਰਿਕ ਸਕੀਮ ਹੈਗੀ ਆ ਉਹਦੇ 'ਚ ਜਿਹੜੇ ਆਪਣਾ ਐੱਸ ਸੀ ਬੱਚੇ ਨੇ ਉਹਨਾਂ ਨੂੰ ਸਾਰੀ ਉਹਨਾਂ ਦੀ ਫੀਸ ਮਾਫ਼ ਆ ਉਹਨਾਂ ਨੂੰ ਸਿਰਫ ਦੋ ਹਜ਼ਾਰ ਰੁਪਿਆ ਦੇਣਾ ਹੁੰਦਾ ਅਤੇ ਇੱਦਾਂ ਦੀਆਂ ਜਿਹੜੀਆਂ ਸਕੀਮਾਂ ਅਸੀਂ ਜਾ ਕੇ ਬੱਚਿਆਂ ਨੂੰ ਦੱਸਦੇ ਸੀ ਤਾਂ ਜੋ ਉਹ ਐਡਮਿਸ਼ਨ ਲੈ ਸਕਣ ਅਤੇ ਇੰਜੀਨੀਅਰਿੰਗ ਦੇ ਕਿੱਤੇ ਨੂੰ ਅਪਣਾ ਸਕਣ ਅਤੇ ਅੱਗੇ ਜਾ ਕੇ ਸਰਕਾਰੀ ਨੌਕਰੀਆਂ ਜਾਂ ਆਪਣੇ ਵਧੀਆ ਸੈੱਟ ਹੋ ਸਕਣ ਅਤੇ ਇਸ ਮਕਸਦ ਨੂੰ ਲੈ ਕੇ ਅਸੀਂ ਬੜੀ ਵਾਰ ਪਿੰਡਾਂ ਅਤੇ ਕਸਬਿਆਂ ਦਾ ਦੌਰਾ ਕੀਤਾ ਜਿਹਦੇ ਦੌਰਾਨ ਸਾਨੂੰ ਬਹੁਤ ਸਾਰੇ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਿਆ ਅਤੇ ਅਸੀਂ ਉਹਨਾਂ ਨੂੰ ਜਾ ਕੇ ਆਪਣੀਆਂ ਸਕੀਮਾਂ ਦੱਸਦੇ ਸੀ ਅਤੇ ਉਹਨਾਂ ਤੋਂ ਪਲੱਸ ਟੂ ਦੇ ਸਕੂਲਾਂ ਤੋਂ ਜਿਹੜੇ ਬੱਚੇ ਨੋਨ ਮੈਡੀਕਲ ਕਰਕੇ ਆਉਂਦੇ ਸੀ ਉਹਨਾਂ ਨੂੰ ਅਸੀਂ ਉਹਨਾਂ ਦਾ ਜਾਂ ਤਾਂ ਲੈ ਆਉਂਦੇ ਸੀ ਨੰਬਰ ਜਾਂ ਐਡਰੈੱਸ ਫੋਨ ਨੰਬਰ ਜਿਹਦੇ ਤਰੀਕੇ ਨਾਲ ਅਸੀਂ ਉਹਨਾਂ ਨੂੰ ਕੰਟੈਕਟ ਕਰ ਸਕੀਏ ਅਤੇ ਇਹ ਫਿਰ ਉਸ ਉਹਨੂੰ ਲਿਆ ਕੇ ਅਸੀਂਂ ਉਹਨੂੰ ਜਾਂ ਤਾਂ ਫੋਨ ਟੈਲੀਫੋਨ ਕਰਦੇ ਸੀ ਜਾਂ ਉਹਨਾਂ ਨੂੰ ਸਮਾਂ ਦੇ ਆਉਂਦੇ ਸੀ ਵੀ ਤੁਸੀਂ ਸਾਡਾ ਕੋਲਜ ਵਿਜ਼ਿਟ ਕਰੋ ਇੱਥੇ ਆ ਕੇ ਉਹ ਸਾਡੀਆਂ ਸਾਰੀਆਂ ਲੈਬੋਰਟਰੀਆਂ ਜਾਂ ਸਾਡੇ ਜਿਹੜੇ ਕਲਾਸ ਰੂਮ ਨੇ ਕੀ ਪੜ੍ਹਾਈ ਹੁੰਦੀ ਹੈ ਕਿੱਦਾਂ ਅਸੀਂ ਪੜ੍ਹਾਉਂਦੇ ਹਾਂ ਉਹ ਸਾਰਾ ਆ ਕੇ ਦੇਖਦੇ ਸੀ ਅਸੀਂ ਇੱਕ ਦਿਨ ਉਹਨਾਂ ਦਾ ਰੱਖ ਦਿੰਦੇ ਸੀ ਉਹਨਾਂ ਨੂੰ ਉੱਥੇ ਕਰ ਆਉਂਦੇ ਸੀ ਮੀਟਿੰਗ ਉਹਨਾਂ ਨਾਲ ਅਤੇ ਉਹਨਾਂ ਨੂੰ ਕਹਿ ਆਉਂਦੇ ਸੀ ਦੱਸ ਆਉਂਦੇ ਸੀ ਵੀ ਜਦੋਂ ਤੁਹਾਡਾ ਟਾਈਮ ਹੈਗਾ ਸਾਨੂੰ ਕੋਲ ਕਰ ਦਿਓ ਫੋਨ ਨੰਬਰ ਆਪਣਾ ਦੇ ਆਉਂਦੇ ਸੀਗੇ ਅਤੇ ਵੀ ਤੁਸੀਂ ਸਾਨੂੰ ਦੱਸ ਦਿਓ ਅਸੀਂ ਅੱਗੇ ਤੁਹਾਡਾ ਸਾਰਾ ਜਿਹੜਾ ਇੰਤਜ਼ਾਮ ਕਰਕੇ ਰੱਖਾਂਗੇ ਇੱਥੇ ਪ੍ਰਬੰਧ ਕੀਤਾ ਹੁੰਦਾ ਸੀ ਉਹਨਾਂ ਨੂੰ ਸਾਰਾ ਆਲ ਘੁਮਾਉਣ ਦਾ ਆਪਣੇ ਕੋਲਜ ਦੇ ਵਿੱਚ ਬਾਰੇ ਦੱਸਣ ਦਾ ਅਤੇ ਇਹਦੇ ਨਾਲ ਬੱਚੇ ਜਿਹੜੇ ਸੀ ਬਾਰਵੀਂ ਤੋਂ ਬਾਅਦ ਅਰਾਮ ਨਾਲ ਸ ਸੋਚ ਸਕਦੇ ਨੇ ਵੀ ਅਸੀਂ ਕਿੱਧਰ ਨੂੰ ਜਾਣਾ ਉਹਨਾਂ ਨੂੰ ਸਾਰੀਆਂ ਸਾਡੀਆਂ ਜਿਹੜੀਆਂ ਇੰਜਨੀਅਰਿੰਗ ਦੀਆਂ ਬਰਾਂਚਾਂ ਨੇ ਉਹਨਾਂ ਦਾ ਅੱਡ ਅੱਡ ਘੁੰਮਾਉਂਦੇ ਸੀ ਵੀ ਆਹ ਕੰਪਿਊਟਰ ਸਾਇੰਸ ਡਿਪਾਰਟਮੈਂਟ ਆ ਆਹ ਜੀ ਹੈਗਾ ਜਿਹੜਾ ਮਕੈਨੀਕਲ ਇੰਜਨੀਅਰਿੰਗ ਡਿਪਾਰਟਮੈਂਟ ਆਹ ਸਿਵਲ ਡਿਪਾਰਟਮੈਂਟ ਆ ਇਹਦੇ 'ਚ ਕੀ ਹੁੰਦਾ ਇਹ ਸਾਰੀ ਜਾਣਕਾਰੀ ਅਸੀਂ ਟਾਈਮ ਟੂ ਟਾਈਮ ਦੇਣ ਲਈ ਅਤੇ ਅਡਮੀਸ਼ਨਾਂ ਦੇ ਜਿਹੜਾ ਇਹਦੇ ਉ ਉਦੇਸ਼ ਦੇ ਨਾਲ ਅਸੀਂ ਆਪਣਾ ਕਸਬੇ 'ਤੇ ਪਿੰਡਾਂ ਦੇ ਵਿੱਚ ਦੌਰਾ ਕਰਦੇ ਸੀ